ਮੇਰੇ ਵੱਲੋਂ ਆਪਣੀ ਸਕੂਲੀ ਪੜ੍ਹਾਈ ਨੌਵੀਂ ਅਤੇ ਦਸਵੀਂ ਕਲਾਸ ਵਿੱਚ ਚਿੱਤਰਕਾਰੀ ਅਤੇ ਡਰਾਇੰਗ ਦੀ ਚੋਣ ਇੱਕ ਚੁਣਵੇਂ ਵਿਸ਼ਿਆਂ ਵਜੋਂ ਕੀਤੀ ਗਈ ਸੀ ਇੱਥੇ ਮੇਰੇ ਵੱਲੋਂ ਮਹਿਸੂਸ ਕੀਤਾ ਗਿਆ ਕਿ ਜਿਹੜੀ ਚਿੱਤਰਕਾਰੀ ਅਤੇ ਪੇਂਟਿੰਗ ਹੈ ਇੱਕ ਤਨਾਅ ਨੂੰ ਦੂਰ ਕਰਦੀ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਅਸੀਂ ਪੇਪਰ 'ਤੇ ਉਤਾਰ ਸਕਦੇ ਹਾਂ ਜਿਸ ਤਰ੍ਹਾਂ ਇੱਕ ਕਵੀ ਜਾਂ ਗੀਤਕਾਰ ਆਪਣੇ ਗੀਤਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ ਇਸੇ ਤਰ੍ਹਾਂ ਹੀ ਇੱਕ ਚਿੱਤਰਕਾਰ ਇੱਕ ਪੇਪਰ 'ਤੇ ਡਰਾਇੰਗ ਅਤੇ ਚਿੱਤਰਕਾਰੀ ਰਾਹੀਂ ਆਪਣੀਆਂ ਭਾਵਨਾਵਾਂ ਅਤੇ ਆਪਣੀ ਕਲਾ ਦਾ ਪ੍ਰਗਟਾਵਾ ਕਰਦਾ ਹੈ ਮੌਜੂਦਾ ਸਮੇਂ ਵਿੱਚ ਵੀ ਕਦੇ ਕਦੇ ਮੇਰੇ ਵੱਲੋਂ ਇਸ ਆਪ ਇਹ ਆਪਣੇ ਸ਼ੌਂਕ ਦੀ ਪੂਰਤੀ ਕਰ ਲਈ ਜਾਂਦੀ ਹੈ ਕਿਉਂਕਿ ਇਹ ਮੈਨੂੰ ਤਨਾਅ ਤੋਂ ਦੂਰ ਰੱਖਦਾ ਹੈ